ਧਰਮ ਸਾਡੇ ਖੇਤਰ ਨੂੰ ਸੈਰ ਸਪਾਟੇ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦਾ ਹੈ ਕੋਈ ਵੀ ਜਗ੍ਹਾ 'ਤੇ ਜਾਈਏ ਉਹ ਧਰਮ ਦੇ ਨਾਲ ਜੁੜਿਆ ਹੁੰਦਾ ਹੈ ਜਿਵੇਂ ਕਿ ਹੁਣ ਅਸੀਂ ਜਾ ਕੇ ਆਏ ਹਾਂ ਰਿਸ਼ੀਕੇਸ਼ ਉੱਤਰਾਖੰਡ ਦਾ ਇਹ ਇੱਕ ਇਲਾਕਾ ਹੈ ਉੱਤਰਾਖੰਡ ਇਹ ਰਾਜ ਦੇ ਵਿੱਚ ਪੈਂਦਾ ਹੈ ਪਰ ਇਸ ਇੱਥੇ ਜਿਹੜੀ ਗੰਗਾ ਮਈਆ ਯਾਨੀ ਕਿ ਗੰਗਾ ਦੀ ਜਿਹੜੀ ਗੰਗਾ ਦਰਿਆ ਹੈ ਉਹ ਵਹਿੰਦਾ ਹੈ ਠੀਕ ਹੈ ਇਹ ਧਰਮ ਦੇ ਨਾਲ ਹੀ ਜੁੜਿਆ ਹੋਇਆ ਗਏ ਤਾਂ ਅਸੀਂ ਸੈਰ ਸਪਾਟੇ ਲਈ ਸੀ ਪਰ ਗੰਗਾ ਮਈਆ ਦੇ ਵੀ ਦਰਸ਼ਨ ਕਰਕੇ ਆਏ ਹਾਂ ਉਹਦੇ ਵਿੱਚ ਵੀ ਗੋਤੇ ਲਗਾ ਕੇ ਆਏ ਹਾਂ ਅਤੇ ਬਹੁਤ ਜ਼ਿਆਦਾ ਥਾਵਾਂ ਨੇ ਜਿਵੇਂ ਕਿ ਤਾਜ ਮਹਿਲ ਹੋ ਗਿਆ ਠੀਕ ਹੈ ਜੀ ਦਿੱਲੀ ਦੇ ਵਿੱਚ ਲਾਲ ਕਿਲ੍ਹਾ ਹੋ ਗਿਆ ਕੁਤਬ ਮੀਨਾਰ ਹੋ ਗਿਆ ਇਹ ਸਭ ਧਰਮ ਦੇ ਨਾਮ ਤੋਂ ਹੀ ਪ੍ਰਸਿੱਧ ਨੇ ਧਾਰਮਿਕ ਖੇਤਰ ਆਪਣਾ ਵੈਸੇ ਤਾਂ ਇਹ ਆਪਣਾ ਹਿਸਟੋਰੀਕਲ ਪਲੇਸ ਨੇ ਪਰ ਧਰਮ ਦੇ ਨਾਲ ਇਹਨਾਂ ਦਾ ਤਾਲੋਕਾਤ ਹੈ ਇੱਥੇ ਬਹੁਤ ਜ਼ਿਆਦਾ ਲੋਕ ਆਉਂਦੇ ਨੇ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਲੋਕ ਆਉਂਦੇ ਨੇ